ਹਾਂ ਮਨਪਸੰਦ ਬੁਣਾਈ ਅਤੇ ਸਿਲਾਈ ਬੁੱਕ ਯੂਟਿਊਬ ਚੈਨਲ ਸੋਸ਼ਲ ਮੀਡੀਆ ਖਾਤਾ ਹੈ ਅਤੇ ਉਸ ਤੋਂ ਮੈਂ ਇਹ ਸਿੱਖਿਆ ਹੈ ਕਿ ਮੈਂ ਆਪਣੇ ਕੰਮ ਨੂੰ ਹੋਰ ਕਿਵੇਂ ਅੱਗੇ ਵਧਾ ਸਕਦੀ ਹਾਂ ਜਦੋਂ ਮੈਂ ਆਪਣੇ ਅਲੱਗ ਅਲੱਗ ਡਿਜ਼ਾਈਨ ਸੂਟ ਕੀਤੇ ਹੋਏ ਪਾਉਂਦੀ ਹਾਂ ਜਾਂ ਮੈਂ ਆਪਣੇ ਕਸਟਮਰਾਂ ਨੂੰ ਅਲੱਗ ਅਲੱਗ ਡਿਜ਼ਾਈਨ ਦੇ ਸੂਟ ਸਿਲਾਈ ਕਰਕੇ ਦਿੰਦੀ ਹਾਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਲੋਕ ਦੂਸਰੇ ਵੀ ਲੋਕ ਉਹਨਾਂ ਨੂੰ ਦੇਖ ਕੇ ਮੇਰੇ ਪਾਸ ਆਪਣੇ ਕੱਪੜੇ ਸਿਲਾਈ ਕਰਨ ਲਈ ਆਉਂਦੇ ਹਨ ਇਸ ਤਰ੍ਹਾਂ ਮੇਰੇ ਹੁਨਰ ਦੀ ਅੱਗੇ ਤੋਂ ਅੱਗੇ ਮਸ਼ਹੂਰੀ ਹੁੰਦੀ ਹੈ